ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਫਲਿੱਪਕਾਟ ਤੋਂ ਬੋਲਦੇ ਪਏ ਹਾਂਜੀ ਮੈਡਮ ਮੈਂ ਰਮਨਦੀਪ ਬੋਲਦਾ ਪਿਆ ਮੈਡਮ ਗੁਰਦਾਸਪੁਰ ਤੋਂ ਮੈਡਮ ਮੈਂ ਆਰਡਰ ਕੀਤਾ ਸੀਗਾ ਪਰਸੋਂ ਬੈਡ ਸ਼ੀਟ ਦਾ ਹਾਂਜੀ ਅਤੇ ਉਹ ਮੈਡਮ ਬੈਡ ਸ਼ੀਟ ਡਿਲੀਵਰ ਤਾਂ ਹੋ ਗਈ ਆ ਹੁਣ ਟਾਈਮ ਹੀ ਬਟ ਮੈਡਮ ਉਹ ਬੈਡ ਸ਼ੀਟ ਜਿਹੜੀ ਆ ਉਹ ਸਹੀ ਨਹੀਂ ਹੈਗੀ ਮੈਡਮ ਉਹ ਉਹ ਜਿਹੜੀ ਆ ਕੁਆਲਿਟੀ ਜਿਹੜੀ ਆ ਉਹ ਅੱਪ ਟੂ ਮਾਰਕ ਨਹੀਂ ਹੈਗੀ ਵਧੀਆ ਨਹੀਂ ਹੈਗੀ ਜਿਸ ਤਰ੍ਹਾ ਦੀ ਉਹ ਦਿਖਾਈ ਗਈ ਉਹ ਉਹੋ ਜਿਹੀ ਨਹੀਂ ਹੈਗੀ ਮੈਡਮ ਜਿੱਦਾਂ ਜੋ ਕਲਰ ਹੈਗਾ ਸੀ ਉਹਦੇ ਵਿੱਚ ਫੋਟੋ ਵਿੱਚ ਜੋ ਦਿਖਦਾ ਪਿਆ ਸੀਗਾ ਉਹ ਜਦੋਂ ਆਈ ਆ ਉਹ ਉਹੋ ਜਿਹਾ ਕਲਰ ਹੈ ਹੀ ਨਹੀਂ ਆ ਅਸਲ ਵਿੱਚ ਦੇਖਣ ਵਿੱਚ ਹੋਰ ਵਾ ਐਕਚੁਅਲ ਵਿੱਚ ਕੁਝ ਹੋਰ ਵਾ ਫੋਟੋ ਵਿੱਚ ਹੋਰ ਆ ਪਹਿਲਾਂ ਦਾ ਪਤਾ ਦਾ ਰੰਗ ਦਾ ਬੜਾ ਫਰਕ ਵਾ ਅਤੇ ਜਦੋਂ ਆਈ ਆ ਉਹ ਸਾਈਜ ਦਾ ਵੀ ਥੋੜ੍ਹਾ ਜਿਹਾ ਫਰਕ ਵਾ ਉਹ ਵਾਸੀਬਲ ਜਿਹੜੀ ਵਾਸ਼ ਕੀਤੀ ਆ ਥੋੜ੍ਹਾ ਜਿਹਾ ਸਾਈ ਵੀ ਜਿਹੜਾ ਉਹਦਾ ਜਿੰਨਾ ਹੈਗਾ ਸੀਗਾ ਉੰਨਾ ਨਹੀਂ ਰਿਹਾ ਥੋੜ੍ਹਾ ਜਿਹਾ ਸ਼ਰਿੰਕ ਹੋ ਗਈ ਅੱਗੇ ਨਾਲੋਂ ਅਤੇ ਉਹ ਬੈਡ 'ਤੇ ਵੀ ਪੂਰੀ ਨਿਗੀ ਆ ਰਹੀ ਅਤੇ ਇਹਦਾ ਕੋਈ ਫ਼ਾਇਦਾ ਤਾਂ ਹੈ ਨਹੀਂ ਹੈ ਪੈਸੇ ਵੀ ਖਰਚੇ ਆ ਅਤੇ ਫਿਰ ਰਿਜ਼ਲਟ ਵੀ ਨਾ ਮਿਲੇ ਤਾਂ ਫਿਰ ਫ਼ਾਇਦਾ ਕੀ ਆ ਮੈਂ ਮੈਡਮ ਚਾਹੁੰਦਾ ਵੀ ਮੈਨੂੰ ਰਿਫੰਡ ਜਿਹੜਾ ਵਾ ਪੂਰੇ ਟਾਈਮ 'ਤੇ ਦੇ ਦਿੱਤਾ ਜਾਵੇ ਰਿਫੰਡ ਪੂਰਾ ਜਿਹੜਾ ਮੈਡਮ ਮੇਰਾ ਅਕਾਊਂਟ 'ਚ ਹੀ ਆਵੇ ਅਤੇ ਆਪ ਮੈਨੂੰ ਫਲਿੱਪਕਾਰਡ ਅਕਾਊਂਟ ਦੇ ਵਿੱਚ ਨਹੀਂ ਗਾ ਚਾਹੀਦਾ ਮੇਰੇ ਅਕਾਊਂਟ ਦੇ ਵਿੱਚ ਚਾਹੀਦਾ ਵਾ ਜਿੱਥੋਂ ਪੇ ਕੀਤਾ ਸੀਗਾ ਉੱਥੇ ਮੇਰਾ ਅਕਾਊਂਟ 'ਚ ਵਿੱਚ ਪੇ ਕਰ ਦਿਓ ਮੇਰਾ ਜਿਹੜਾ ਵਾ ਬਣਦਾ ਰਿਫੰਡ ਜੇ ਮੈਮ ਟੈ ਟਾਈਮ 'ਤੇ ਨਹੀਂ ਕਰ ਸਕਦੇ ਤੁਸੀਂ ਮੈਨੂੰ ਤਾਂ ਮੇਰੀ ਆਪਣਾ ਆਪਰ ਹੈਡ ਦੇ ਨਾਲ ਮੈਡਮ ਗੱਲ ਕਰਾ ਦਿਓ ਤੁਸੀਂ ਤਾਂ ਕਿ ਮੈਂ ਆਪਣਾ ਰਿਫੰਡ ਜਿਹੜਾ ਵਾ ਟਾਈਮ ਸਿਰ ਲੈ ਸਕਾਂ ਮੈਡਮ ਠੀਕ ਆ ਮੈਮ